ਹਾਂਜੀ ਮੈਮ ਸਤਿ ਸ਼੍ਰੀ ਅਕਾਲ ਮੈਮ ਮੈਂ ਮੈਮ ਰਮਨਦੀਪ ਕੌਰ ਬੋਲ ਰਹੀ ਹਾਂ ਐਕੁਚਲ਼ੀ ਮੈਮ ਮੈਂ ਨਾ ਨਵੀਂ ਨਵੀਂ ਜਿਹੜੀ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਮੈਂ ਪਹਿਲਾਂ ਮੈਂ ਜੋਧਪੁਰ ਤੋਂ ਉੱਧਰੋਂ ਰਾਜਸਥਾਨ ਦੀ ਰਹਿਣ ਵਾਲੀ ਸੀਗੀ ਮੈਮ ਮੈਨੂੰ ਨਾ ਮੈਂ ਮਤਲਬ ਮੈਮ ਮੈਨੂੰ ਮੇਰੀ ਫਰੈਂਡ ਨੇੇ ਤੁਹਾਡਾ ਨੰਬਰ ਦਿੱਤਾ ਸੀਗਾ ਮੈਮ ਮੈਂ ਐਕਚੁਲੀ ਫੁਲਕਾਰੀ ਦੇ ਬਾਰੇ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਵੀ ਇੱਕ ਤਾਂ ਪੰਜਾਬ ਦੇ ਵਿੱਚ ਕਿਹੜੀਆਂ ਕਿਹੜੀਆਂ ਫੁਲਕਾਰੀਆਂ ਅਤੇ ਕਿੱਥੋਂ ਮਿਲ ਸਕਦੀਆਂ ਮੈਮ ਹਾਂਜੀ ਠੀਕ ਹੈ ਜੀ ਠੀਕ ਹੈ ਮੈਮ ਹਾਂਜੀ ਹਾਂਜੀ ਹਾਂਜੀ ਠੀਕ ਹੈ ਮੈਮ ਇੱਕ ਮੈਮ ਮੈਨੂੰ ਅਤੇ ਮੈਮ ਇੱਕ ਉਹਨਾਂ ਦੀ ਕੋਸਟ ਕੀ ਰਹੇਗੀ ਅਤੇ ਇੱਕ ਠੀਕ ਹੈ ਮੈਮ ਇੱਕ ਮੈਮ ਜੁੱਤੀ ਦੇ ਬਾਰੇ ਜੁੱਤੀ ਦੇ ਬਾਰੇ ਵੀ ਪੁੱਛਣਾ ਸੀ ਵੀ ਜੁੱਤੀ ਕਿੱਥੋਂ ਵਧੀਆ ਮਿਲੇਗੀ ਹਾਂਜੀ ਹਾਂਜੀ ਪੰਜਾਬੀ ਜੁੱਤੀ ਮੈਮ ਹਾਂਜੀ ਓਕੇ ਅੱਛਾ ਠੀਕ ਹੈ ਮੈਮ ਠੀਕ ਹੈ ਓਕੇ ਮੈਮ ਮੈਮ ਪੰਜਾਬੀ ਜੁੱਤੀ ਦੀ ਕੁਆਲਿਟੀ ਵਧੀਆ ਹੋਵੇਗੀ ਓਕੇ ਓਕੇ ਮੈਮ ਠੀਕ ਹੈ ਮੈਮ ਥੈਂਕ ਓਕੇ ਮੈਮ ਹਾਂਜੀ

ਠੀਕ ਹੈ ਮੈਮ ਥੈਂਕ ਯੂ ਸੋ ਮਚ ਮੈਮ ਥੈਂਕ ਯੂ ਓਕੇ ਜੀ ਓਕੇ ਹੈਲਪ ਲਈ ਥੈਂਕ ਯੂ ਮੈਮ